ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਚੌਧਰੀ ਟੂਰ ਐਂਡ ਟਰੈਵਲਸ ਤੋਂ ਗੱਲ ਕਰ ਰਹੇ ਹੋ ਭਾਅ ਜੀ ਭਾਅ ਜੀ ਮੈਂ ਤੁਹਾਡੇ ਇੱਕ ਹਫ਼ਤਾ ਪਹਿਲਾਂ ਮਨਾਲੀ ਨੂੰ ਗੱਡੀ ਲੈ ਕੇ ਗਏ ਸੀ ਮੈਂ ਭਾਅ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਐਕਸਪੀਰੀਅੰਸ ਬਹੁਤ ਵਧੀਆ ਲੱਗਿਆ ਵੈਸੇ ਮੈਂ ਤੁਹਾਨੂੰ ਭਾਅ ਜੀ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਔਨਲਾਈਨ ਯੂ ਪੀ ਆਈ ਭੁਗਤਾਨ ਕਰ ਸਕਦੇ ਹੋ ਮੈਂ ਤੁਹਾਨੂੰ ਔਨਲਾਈਨ ਭੁਗਤਾਨ ਕਰਨਾ ਚਾਹੁੰਦਾ ਉਸ ਟੈਮ ਤੁਹਾਡੀ ਸਾਰੀ ਪੇਮੈਂਟ ਕਲੀਅਰ ਕਰਨੀ ਚਾਹੁੰਦਾ ਉਸ ਟੈਮ ਮੇਰੇ ਕੋਲ ਭਾਅ ਜੀ ਕੈਸ਼ ਹੈ ਨਹੀਂ ਤਾ ਵਰਨਾ ਮੈਂ ਤੁਹਾਡੀ ਦੁਕਾਨ 'ਤੇ ਆ ਕੈਸ਼ ਦੇ ਸਕਦਾ ਜੇ ਤੁਹਾਡੇ ਕੋਲ ਔਨਲਾਈਨ ਪੇਮੈਂਟ ਹੈਗੀ ਹੈ ਤਾਂ ਔਨਲਾਈਨ ਪੇਮੈਂਟ ਤੁਸੀਂ ਦੇ ਸਕਦੇ ਹੋ ਭਾ ਔਨਲਾਈਨ ਤੁਹਾਨੂੰ ਭੁਗਤਾਨ ਕਰ ਦੂੰਗਾ ਭਾਅ ਜੀ ਉਹ ਤੁਹਾਡਾ ਸਾਰੇ ਪੇਮੈਂਟ ਮੈਂ ਔਨਲਾਈਨ ਭੁਗਤਾਨ ਕਰ ਸਕਦਾ ਜੇ ਤੁਹਾਡੇ ਕੋਲ ਨਹੀਂ ਤੁਹਾਨੂੰ ਮੈਂ ਕੈਸ਼ ਪੇਮੈਂਟ ਵੀ ਕਰ ਸਕਦਾ ਹਾਂ